ਕੌਣ ਬੋਲ ਰਹਾ ਹੈ ਅ ਕੌਣ ਬੋਲ ਰਿਹਾ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਤੁਹਾਨੂੰ ਮੇਰਾ ਨੰਬਰ ਕਿੱਥੋਂ ਮਿਲਿਆ ਠੀਕ ਹੈ ਅਤੇ ਆਪਣਾ ਕੇਸ ਕਿਸ ਸਿਲਸਿਲੇ ਬਾਰੇ ਹੈ ਠੀਕ ਹੈ ਹਾਂਜੀ ਹਾਂਜੀ ਅੱਛਾ ਉਹ ਤਾਂ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਅਤੇ ਜਿਵੇਂ ਤੁਸੀਂ ਚਾਰੋਂ ਪੁੱਤਰਾਂ ਦੇ ਵਿੱਚ ਬਰਾਬਰ ਬਰਾਬਰ ਵੰਡਣੀ ਆ ਜਾਂ ਕਿਸੇ ਨੂੰ ਜ਼ਿਆਦਾ ਦੇਣੀ ਕਿਸੇ ਨੂੰ ਘੱਟ

ਅੱਛਾ ਤਾਂ ਜਿਹੜੀ ਤੁਸੀਂ ਜ਼ਮੀਨ ਕਹਿ ਰਹੇ ਹੋ ਉਹਦੇ ਕਾਗਜ਼ ਪਹਿਲਾਂ ਤੋਂ ਪੂਰੇ ਹੈ ਰਜਿਸਟਰੇਸ਼ਨ ਵਗੈਰਾ ਕੀਤੀ ਹੋਈ ਆ ਤਾਂ ਫਿਰ ਉਹ ਕਾਗਜ਼ਾਂ ਦੀ ਜ਼ਰੂਰਤ ਤਾਂ ਪਏਗੀ ਉਹਨਾਂ ਨੂੰ ਤੁਸੀਂ ਲੱਭ ਕੇ ਰੱਖੋ ਨਾ ਕਾਗਜ਼ ਦੀ ਜਿਵੇਂ ਰਜਿਸਟਰੇਸ਼ਨ ਕਰਵਾਉਣੀ ਆ ਰਜਿਸਟਰੀ ਵਗੈਰਾ ਇਹ ਸਾਰਾ ਕੁਝ ਨਹੀਂ ਤਾਂ ਅਗਰ ਕੋਰਟ ਤੋਂ ਵੀ ਹੋ ਜਾਂਦਾ ਵਾ ਤੁਸੀਂ ਕੋਰਟ ਤੋਂ ਕਰਵਾ ਲਓ ਇੱਕ ਵਾਰ ਕਾਗਜ਼ ਸਾਰੇ ਤਿਆਰ ਕਰ ਲਓ ਅਤੇ ਫਿਰ ਮੈਂ ਤਾਂ ਫਿਰ ਡਾਇਰੈਕਟ ਤੁਹਾਡਾ ਡਿਸਟਰੀਬਿਊਸ਼ਨ ਵਾਲਾ ਕੰਮ ਕਰਾਂਗੀ ਨਾ ਅਤੇ ਜਿਹੜੇ ਕਾਗਜ਼ ਦੇ ਜਿਹੜੇ ਪੱਤਰ ਹੈਗੇ ਦਸਤਾਵੇਜ਼ ਇਹ ਤਾਂ ਤੁਸੀਂ ਇਕੱਠੇ ਕਰਕੇ ਰੱਖਣੇ ਆ ਨਾ ਠੀਕ ਐ ਮੈਂ ਜਿੰਨੀ ਮੇਰੇ ਤੋਂ ਹੈਲਪ ਹੋ ਸਕੀ ਮਦਦ ਵੱਧ ਤੋਂ ਵੱਧ ਮੈਂ ਤੁਹਾਡੀ ਕਰੂੰਗੀ ਕੋਈ ਨਹੀਂ ਉਹ ਆਪਾਂ ਦੇਖ ਲਵਾਂਗੇ ਤੁਸੀਂ ਜਦੋਂ ਮਰਜ਼ੀ ਆ ਜਾਓ ਸਵੇਰੇ ਨੌਂ ਤੋਂ ਸ਼ਾਮ ਦੇ ਦਸ ਵਜੇ ਤੱਕ ਮਤਲਬ ਨੌਂ ਵਜੇ ਮੇਰਾ ਆਫਿਸ ਖੁਲ੍ਹ ਜਾਂਦਾ ਵਾ ਨਾ ਪਹਿਲਾਂ ਤੁਹਾਨੂੰ ਨਾ ਅਪੋਆਇੰਟਮੈਂਟ ਲੈਣੀ ਪੈਣੀ ਆ ਨਹੀਂ ਜਿਵੇਂ ਤੁਸੀਂ ਮੇਰੇ ਆਫਿਸ ਆਉਗੇ ਨਾ ਇੱਦਾਂ ਡਾਇਰੈਕਟ ਆਣਉ ਨਹੀਂ ਦਿੰਦੇ ਇਸ ਲਈ ਪਹਿਲਾਂ ਤੁਹਾਨੂੰ ਅਪੋਇੰਟਮੈਂਟ ਲੈਣੀ ਪੈਣੀ ਆ ਕਹਿਓ ਕਿ ਮੋਨਿਕਾ ਐਡਵੋਕੇਟ ਦੇ ਨਾਲ ਗੱਲ ਹੈਗੀ ਆ ਤੁਹਾਡੀ ਅਤੇ ਉਹਦੀ ਅਪੋਆਇੰਟਮੈਂਟ ਲੈਣੀ ਹੈ ਤੁਸੀਂ ਕੋਈ ਨਹੀਂ ਆਹੀ ਨੰਬਰ 'ਤੇ ਕਾਲ ਕਰ ਲਿਓ ਮੈਂ ਤੁਹਾਨੂੰ ਦੱਸ ਦਊਂ ਨਹੀਂ ਮੇਰੇ ਅਸਿਸਟ ਕੀਤੇ ਹੋਏ ਅੱਗੇ ਮੈਂ ਉਹਨਾਂ ਨੂੰ ਦੱਸ ਦਊਂਗੀ ਨਾ ਤੁਹਾਡੇ ਬਾਰੇ ਕੋਈ ਨਹੀਂ ਤੁਸੀਂ ਆਇਓ ਨੌਂ ਵਜੇ ਆ ਜਾਓ ਕੱਲ੍ਹ ਸਵੇਰੇ ਉਹ ਕੋਈ ਨਹੀਂ ਆਪਾਂ ਦੇਖ ਲਵਾਂਗੇ ਜਿਵੇਂ ਜਿਵੇਂ ਕਰਨੀ ਆ ਕੋਈ ਨਹੀਂ ਜਿੰਨੀ ਤੁਸੀਂ ਦੇ ਸਕਦੇ ਹੋ ਹਾਂਜੀ

ਨਹੀਂ ਜਿਵੇਂ ਥੋੜ੍ਹੀ ਬਹੁਤ ਫੀਸ ਤਾਂ ਲੱਗੇਗੀ ਦੋ ਹਜ਼ਾਰ ਦੋ ਹਜ਼ਾਰ ਜਾਂ ਢਾਈ ਹਜ਼ਾਰ ਠੀਕ ਹੈ